ਮੇਰੇ ਇਸ ਖੇਤਰ ਵਿੱਚ ਜ਼ਿਆਦਾ ਵਰਤੇ ਜਾਣ ਵਾਲੀਆਂ ਕੰਪਨੀਆਂ ਜੀਓ ਸਿੰਮ ਹਨ ਅਤੇ ਇੱਥੇ ਅਗਰ ਨੈੱਟਵਰਕ ਦੀ ਗੱਲ ਕਰੀਏ ਜੋ ਕਿ ਤੇਜ਼ ਹੈ ਉਹ ਹੈ ਫੋਰਜੀ ਤੇ ਫਾਈਵਜੀ ਫੋਰਜੀ ਤੇ ਫਾਈਵਜੀ ਨੈੱਟਵਰਕ ਆਮ ਪੰਜਾਬ ਦੇ ਵਿੱਚ ਜਾਂ ਪੂਰੇ ਸਾਡੇ ਖੇਤਰ ਦੇ ਵਿੱਚ ਵਧੀਆ ਚੱਲਦਾ ਹੈ ਅਤੇ ਸਾਰੇ ਲੋਕ ਉਹਨੂੰ ਚਲਾਉਣਾ ਬਹੁਤ ਪਸੰਦ ਕਰਦੇ ਹਨ ਅਤੇ ਉਹ ਵਾਈਫਾਈ ਜਾਂ ਫਿਰ ਫੋਨ ਦੇ ਵਿੱਚ ਅਗਰ ਸਿੰਮ ਦੀ ਗੱਲ ਕਰੀਏ ਤਾਂ ਉਹ ਆਪਣੇ ਮੋਬਾਇਲ ਫੋਨ ਜੋ ਕਿ ਸਭ ਦੇ ਕੋਲ ਅੱਜ ਕੱਲ੍ਹ ਹੁੰਦੇ ਹਨ ਉਹ ਆਪਣੇ ਮੋਬਾਇਲ ਫੋਨ ਜਾਂ ਕੰਪਿਊਟਰ ਨੂੰ ਆਹੀ ਸਿੰਮਾਂ ਦੇ ਦੁਆਰਾ ਚਲਾਇਆ ਚਲਾ ਚਲਾਉਂਦੇ ਹਨ